ਜੀ ਬਿਲਕੁਲ ਬੋਲੀਵੁੱਡ ਟਾਲੀਵੁੱਡ ਨੇ ਭਾਰਤ ਦੀ ਹਰ ਥਾਂ ਫੈਸ਼ਨ ਨੂੰ ਜ਼ਿਆਦਾ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਬਟ ਜਿਹੜੇ ਪੰਜਾਬੀ ਫਿਲਮਾਂ ਵਿੱਚ ਜਿਹੜੀਆਂ ਡਰੈਸਿਸ ਹੈ ਉਹ ਬਹੁਤ ਹੀ ਡੀਸੈਂਟ ਔਰ ਵਧੀਆ ਹੁੰਦੀਆਂ ਸੋ ਆਪਾਂ ਡੈਫੀਨੇਟਲੀ ਉਹਨਾਂ ਨੂੰ ਕਾਪੀ ਕੀਤਾ ਪੰਜਾਬੀ ਸੂਟ ਮੋਸਟਲੀ ਆਪਾਂ ਉਹਨਾਂ ਦਾ ਹੀ ਕਾਪੀ ਕਰਦੇ ਹਾਂ ਕਿ ਕਿਵੇਂ ਕਿਵੇਂ ਕਿਹਦੇ ਨਾਲ ਕੀ ਕੰਟਰਾਸਟ ਕੀਤਾ ਗਿਆ ਕਿਹੜੇ ਕਲਰ ਦੇ ਨਾਲ ਕਿਹੜਾ ਕਲਰ ਜਿਹੜਾ ਉਹ ਜ਼ਿਆਦਾ ਸੂਟ ਕਰ ਰਿਹਾ ਅਤੇ ਪਹਿਲਾਂ ਤਾਂ ਮੈਂ ਕਲਰ ਕੋਂਬੀਨੇਸ਼ਨ ਕਾਫੀ ਘੱਟ ਹੁੰਦੇ ਸੀਗੇ ਜਿੱਦਾਂ ਕਿ ਗ੍ਰੇਅ ਦੇ ਨਾਲ ਲੈਮਨ ਦਾ ਕੋਂਬੀਨੇਸ਼ਨ ਹੈ ਇਹ ਵੀ ਟੀ ਵੀ 'ਚ ਹੀ ਆਇਆ ਤਾਂ ਹੀ ਆਪਾਂ ਉਹਨੂੰ ਫੋਲੋ ਕੀਤਾ ਗ੍ਰੇਅ ਉਸ ਤੋਂ ਇਲਾਵਾ ਡਾਕ ਲਾਈਟ ਦਾ ਕੋਂਬੀਨੇਸ਼ਨ ਵੀ ਟੀ ਵੀ 'ਚ ਐਕਟਰਸ ਨੇ ਪੰਜਾਬੀ ਐਕਟਰਾਂ ਨੇ ਪਾਉਣਾ ਸ਼ੁਰੂ ਕੀਤਾ ਫਿਰ ਆਪਾਂ ਉੱਥੋਂ ਕਾਪੀ ਕੀਤਾ ਔਰ ਵਧੀਆ ਵੀ ਲੱਗਦਾ ਔਰ ਮੋਸਟਲੀ ਜਿਹੜੇ ਪੰਜਾਬੀ ਡਰੈਸਸ ਹੈ ਉਹ ਆਈ ਥਿੰਕ ਸਿਰਫ ਆਪਾਂ ਹੀ ਨਹੀਂ ਕਾਫੀ ਦੁਨੀਆ ਜਿਹੜੀ ਆ ਉਹਨੂੰ ਕੋਪੀ ਕਰਦੀ ਆ ਔਰ ਪੰਜਾਬੀ ਦੁਪੱਟੇ ਦਾ ਜਿਹੜਾ ਹੁੰਦਾ ਹੈ ਵੇਅ ਕਿ ਉਹਨੂੰ ਕਿਸ ਤਰ੍ਹਾਂ ਲੈਣਾ ਵੱਖਰੇ ਵੱਖਰੇ ਤਰੀਕੇ ਨਾਲ ਜਿਹੜਾ ਉਹਨੂੰ ਲੈਣਾ ਕਿੱਧਰ ਨੂੰ ਘੁੰਮਾ ਕੇ ਲੈਣਾ ਜਾਂ ਇਵੇਂ ਘੁੰਮਾ ਕੇ ਲੈਣਾ ਇਹ ਵੀ ਸਭ ਕੁਝ ਆਪਾਂ ਉੱਥੋਂ ਹੀ ਦੇਖਿਆ ਉਸ ਤੋਂ ਇਲਾਵਾ ਹੋਰ ਵੀ ਹੇਅਰ ਸਟਾਈਲਸ ਵੀ ਆਪਾਂ ਦੇਖੇ ਆ ਉਹਨੂੰ ਕੋਪ ਕੋਪੀ ਕਰ ਲੈਂਦੇ ਕਿ ਇਹ ਸੂਟ ਦੇ ਨਾਲ ਪਰਾਂਦਾ ਪਾਇਆ ਸਹੀ ਲੱਗੇਗਾ ਇਹ ਸੂਟ ਦੇ ਨਾਲ ਵਾਲ ਖੁੱਲ੍ਹੇ ਸਹੀ ਲੱਗਣਗੇ ਇਹ ਸਭ ਕੁਛ ਸਾਨੂੰ ਟੀ ਵੀ 'ਚੋਂ ਦੇਖ ਕੇ ਹੀ ਪਤਾ ਲੱਗਦਾ ਔਰ ਕਾਫੀ ਕੁਛ ਹੋਰ ਵੀ ਨਵਾਂ ਸਿੱਖਣ ਨੂੰ ਮਿਲਦਾ ਜ਼ਰੂਰ ਟੀ ਵੀ ਦੇ ਵਿੱਚੋਂ ਸੂਟਾਂ ਦੇ ਲਈ ਕਿ ਕਿਹੜਾ ਸੂਟ ਨਾਲ ਸਲਵਾਰ ਸੋਹਣੀ ਲੱਗਦੀ ਹੈ ਜਾਂ ਕਿਹੜੇ ਸੂਟ ਨਾਲ ਪਜਾਮੀ ਸੋਹਣੀ ਲੱਗੇਗੀ ਕਿਹੜੇ ਸੂਟ ਨਾਲ ਕਿਵੇਂ ਦੀ ਚੱਪਲ ਸਹੀ ਲੱਗੇਗੀ ਇਸ ਕਾਫੀ ਕੁਛ ਸਿੱਖਣ ਨੂੰ ਮਿਲਦਾ ਔਰ ਕਾਫੀ ਕੁਛ ਆਪਾਂ ਬਣਵਾਇਆ ਵੀ ਹੈ ਉਹਦੇ ਨਾਲ ਦਾ